ਪੰਜਾਬੀ ਭਾਸ਼ਾ ਦੇਸ਼ ਦੀ ਇੱਕ ਅਮੀਰ ਭਾਸ਼ਾ ਹੈ ਅਤੇ ਇਹ ਵਿਸ਼ਵ ਵਿੱਚ ਮੌਜੂਦਾ ਸਮੇਂ ਵਿੱਚ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਇੱਥੇ ਦੱਸਣ ਯੋਗ ਹੈ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਪ੍ਰਸਾਰ ਅਤੇ ਪਸਾਰ ਗੁਰੂ ਕਾਲ ਤੋਂ ਸ਼ੁਰੂ ਹੋਇਆ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਪੰਜਾਬੀ ਭਾਸ਼ਾ ਦੇ ਸ਼ਬਦ ਘੜੇ ਅਤੇ ਇਹਨਾਂ ਨੂੰ ਇੱਕ ਤਰਤੀਬ ਦਿੱਤੀ ਜਿਸ ਦੀ ਗੁਰਮੁਖੀ ਲਿਪੀ ਜਿਸ ਨੂੰ ਕਿਹਾ ਜਾਂਦਾ ਹੈ ਇਸ ਭਾਸ਼ਾ ਵਿੱਚ ਇਸ ਇਹ ਇਸ ਭਾਸ਼ਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਲਿਖੀ ਗਈ ਹੈ ਅਤੇ ਇੱਥੇ ਦੱਸਣ ਯੋਗ ਹੈ ਕਿ ਪੁਰਾਣੇ ਸਮੇਂ ਵਿੱਚ ਜਿਸ ਤਰ੍ਹਾਂ ਸਿੱਖ ਕੌਮ ਜੰਗਾਂ ਯੁੱਧਾਂ ਵਿੱਚ ਜੂਝਦੀ ਰਹੀ ਅਤੇ ਇੱਥੇ ਬਾਹਰੀ ਹਮਲਾਵਰਾਂ ਨੇ ਵੀ ਹਮਲੇ ਕੀਤੇ ਇਸ ਕਰਕੇ ਪੰਜਾਬੀ ਬੋਲੀ ਦੇ ਪ੍ਰਸਾਰ ਪ੍ਰਸਾਰ ਵਿੱਚ ਕਿਤੇ ਨਾ ਕਿਤੇ ਉਸ ਅਨੁਸਾਰ ਵਾਧਾ ਅਤੇ ਵਿਕਾਸ ਨਹੀਂ ਹੋ ਸਕਿਆ ਜਿਸ ਅਨੁਸਾਰ ਹੋਣਾ ਚਾਹੀਦਾ ਸੀ ਕਿਉਂਕਿ ਇਸ ਤੋਂ ਇਲਾਵਾ ਆਧੁਨਿਕ ਯੁੱਗ ਵਿੱਚ ਵੀ ਨਵੇਂ ਨਵੇਂ ਸ਼ਬਦਾਂ ਦੀ ਆਉਣ ਕਾਰਣ ਇਸ ਦੇ ਪੰਜਾਬੀ ਭਾਸ਼ਾ ਦੇ ਸ਼ਬਦ ਕੋਸ਼ ਵਿੱਚ ਤਾਂ ਵਾਧਾ ਹੋਇਆ ਹੈ ਪਰੰਤੂ ਕਈ ਸ਼ਬਦ ਜਿਸ ਤਰ੍ਹਾਂ ਕੰਪਿਊਟਰ ਟੀ ਵੀ ਅਤੇ ਮੋਬਾਇਲ ਫੋਨ ਆਦਿ ਉਹ ਅੰਗਰੇਜ਼ੀ ਵਾਲੇ ਸ਼ਬਦ ਹੀ ਪੰਜਾਬੀ ਭਾਸ਼ਾ ਵਿੱਚ ਬੋਲੇ ਜਾਂਦੇ ਹਨ ਇਸ ਤੋਂ ਇਲਾਵਾ ਸਮੇਂ ਦੀ ਤਬਦੀਲੀ ਦੇ ਨਾਲ ਬੱਚਿਆਂ ਵੱਲੋਂ ਅੰਗਰੇਜ਼ੀ ਮਾਧਿਅਮ ਨੂੰ ਸਕੂਲਾਂ ਵਿਚ ਪੜ੍ਹਣ ਕਰਕੇ ਪੰਜਾਬੀ ਨੂੰ ਉੰਨੀ ਤਰਜੀਹ ਨਹੀਂ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਕ ਪੰਜਾਬੀਆਂ ਵਿਚ ਵਿਦੇਸ਼ ਜਾਣ ਦੀ ਹੋੜ ਨੇ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਪ੍ਰਸਾਰ ਨੂੰ ਪ੍ਰਭਾਵਿਤ ਕੀਤਾ ਹੈ ਕਿਉਂਕਿ ਅੰਗਰੇਜ਼ੀ ਸਕੂਲਾਂ ਵਿੱਚ ਜਾਣ ਕਰਕੇ ਬੱਚੇ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਦੇ ਠੇਠ ਸ਼ਬਦ ਸਿੱਖਣ ਤੋਂ ਵਾਂਝੇ ਰਹਿ ਰਹੇ ਹਨ ਇਸ ਤੋਂ ਇਲਾਵਾ ਬਜ਼ੁਰਗਾਂ ਨਾਲ ਨਾ ਬੈਠਣ ਕਰਕੇ ਵੀ ਉਹਨਾਂ ਨੂੰ ਕਈ ਪੰਜਾਬੀ ਭਾਸ਼ਾ ਦੇ ਸ਼ਬਦਾਂ ਦਾ ਪੂਰਨ ਗਿਆਨ ਨਹੀਂ ਹੈ ਅਤੇ ਉਹਨਾਂ ਵੱਲੋਂ ਇਸ ਨੂੰ ਲਿਖਣ ਅਤੇ ਬੋਲਣ ਸਮੇਂ ਵੀ ਉਚਾਰਨ ਇਸ ਦਾ ਗਲਤ ਕੀਤਾ ਜਾਂਦਾ ਹੈ